ਉੱਨੀ ਸੌ ਚੁਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਦੇ ਕਈ ਕਾਰਨ ਅਤੇ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ ਜਿਸ ਦੇ ਕਈ ਕਾਰਨ ਹਨ ਇੰਦਰਾ ਗਾਂਧੀ ਜੋ ਕਿ ਇੱਕ ਪੇਸ਼ੇ ਵਜੋਂ ਲੀਡਰ ਸੀ ਜਿਸ ਨੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਜਿਸ ਦੇ ਕਰਕੇ ਸਿੱਖਾਂ ਨੂੰ ਕਾਫ਼ੀ ਗੁੱਸਾ ਆਇਆ ਅਤੇ ਇੰਦਰਾ ਗਾਂਧੀ ਦੇ ਦੁਆਰਾ ਫੌਜਾਂ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਜਿਸ ਦੇ ਕਾ ਕੇ ਹਰਿਮੰਦਰ ਸਾਹਿਬ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਗ੍ਰੰਥ ਸਾਹਿਬ ਜੀ ਦੇ ਉੱਤੇ ਵੀ ਹਮਲਾ ਕੀਤਾ ਗਿਆ ਜਿਹੜਾ ਕਿ ਇੱਕ ਪਵਿੱਤਰ ਗ੍ਰੰਥ ਹੈ ਜਿਹੜਾ ਕਿ ਗੁਰੂ ਸਾਹਿਬਾਨ ਨੇ ਆਪਣੇ ਹੱਥਾਂ ਦੇ ਨਾਲ ਲਿਖ ਕੇ ਸ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਸੀ ਇਸ ਦੇ ਕਈ ਕਾਰਨ ਹਨ ਇੰਦਰਾ ਗਾਂਧੀ ਨੇ ਆਪਣੀਆਂ ਫੌਜਾਂ ਦੇ ਦੁਆਰਾ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾਇਆ ਕਿਉਂਕਿ ਸ਼ਿ ਉਹ ਸਿੱਖਾਂ ਤੋਂ ਨਫ਼ਰਤ ਕਰਦੀ ਸੀ ਇਸ ਕਰਕੇ ਉਸ ਨੇ ਗ੍ਰੰਥ ਸਾਹਿਬ ਅਤੇ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਇਹ ਹਮਲਾ ਕਰਵਾਇਆ ਇਸ ਹਮਲੇ ਦੇ ਵਿੱਚ ਕਾਫ਼ੀ ਸਿੰਘ ਸ਼ਹੀਦ ਹੋਏ ਅਤੇ ਸਿੰਘਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਕਾਫ਼ੀ ਜਾਨੀ ਮਾਲੀ ਹ ਜਾਨੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸਿੱਖਾਂ ਦੇ ਕਈ ਗ੍ਰੰਥ ਗ ਹਰਿਮੰਦਰ ਸਾਹਿਬ ਜੀ ਦੀ ਲਾਇਬਰੇਰੀ ਦੇ ਵਿੱਚ ਹਜੇ ਤੱਕ ਨਹੀਂ ਮਿਲੇ ਅਤੇ ਇਸ ਦੇ ਕਈ ਕਾਰਨ ਹਨ ਇਸ ਦਾ ਬਦਲਾ ਲੈਣ ਵਾਸਤੇ ਇੰਦਰ ਇੰਦਰਾ ਗਾਂਧੀ ਨੂੰ ਸਿਖ ਸਿੱਖਾਂ ਨੇ ਇਕੱਤੀ ਅਕਤੂਬਰ ਨੂੰ ਮੌਤ ਦੇ ਘਾਟ ਉਤਾਰ ਕੇ ਆਪਣਾ ਬਦਲਾ ਲਿਆ ਅਤੇ ਅਤੇ ਆਪਣੇ ਆਪਣੇ ਅਪਮਾਨ ਦਾ ਬਦਲਾ ਲਿਆ ਅਤੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦਾ ਬਦਲਾ ਲਿਆ